ਜੀ ਹਾਂ ਆਪਣੇ ਖੇਤਰ ਵਿੱਚ ਖੇਡ ਖੇਤਰ ਦੁਆਰਾ ਚਲਾਏ ਜਾਣ ਵਾਲ਼ੇ ਸਿਹਤ ਤੰਦਰੁਸਤੀ ਅਤੇ ਤੰਦਰੁਸਤੀ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਹਾਂ ਅਸੀਂ ਇਸ ਵਿੱਚ ਮੈਂ ਆਪਣੇ ਪਿੰਡ ਵੱਲੋਂ ਇੱਕ ਦੌੜ ਦੇ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਉਸ ਦੇ ਵਿੱਚ ਮੈਨੂੰ ਪਹਿਲਾ ਪ੍ਰਾਈਜ਼ ਮਿਲਿਆ ਜਿਸ ਦੇ ਨਾਲ਼ ਮੇਰੇ ਪਿੰਡ ਸਕੂਲ ਅਤੇ ਮੇਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਹੋਇਆ ਇਸ ਦੇ ਨਾਲ਼ ਮੇਰੇ ਮਾਂ ਬਾਪ ਅਤੇ ਸਕੂਲ ਦੇ ਮਾਸਟਰ ਸਾਹਿਬਾਨ ਨੂੰ ਤਾਂ ਖੁਸ਼ੀ ਪ੍ਰਾਪਤ ਹੋਣੀ ਹੀ ਸੀ ਇਸ ਦੇ ਨਾਲ਼ ਮੈਨੂੰ ਵੀ ਬਹੁਤ ਜ਼ਿਆਦੇ ਖੁਸ਼ੀ ਪ੍ਰਾਪਤ ਹੋਈ ਇਸ ਦੇ ਨਾਲ਼ ਮੇਰੀ ਸਿਹਤ ਦੇ ਵਿੱਚ ਵੀ ਬਹੁਤ ਵਧੀਆ ਅਸਰ ਪੈਂਦਾ ਹੈ ਅਤੇ ਅੱਗੇ ਹੋਰ ਵੀ ਕਈ ਮੁਕਾਬਲੇ ਜਿੱਤਣ ਦੀ ਮੈਂ ਆਸ ਰੱਖਦਾ ਹਾਂ ਅਤੇ ਇਸ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਲਾਭ ਹਨ ਜੇਕਰ ਅਸੀਂ ਇਸ ਨੂੰ ਚੰਗੇ ਤਰੀਕੇ ਨਾਲ਼ ਖੇਡਾਂਗੇ ਤਾਂ ਅਸੀਂ ਬਹੁਤ ਸਾਰੇ ਲਾਭ ਲੈ ਸਕਦੇ ਹਾਂ